ਓਡਰ ਰੱਦ ਕਰਨ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਜਿਵੇਂ ਕੀ ਓਡਰ ਇਤਿਹਾਸ ਤੇ ਜਾਓ ਸਭ ਤੋਂ ਪਹਿਲਾਂ ਉਸ ਔਨਲਾਈਨ ਸਟੋਰ ਜਾਂ ਐਪ ਤੇ ਜਾਓ ਜਿੱਥੋਂ ਤੁਸੀਂ ਡਰੈਸ ਓਡਰ ਕੀਤੀ ਸੀ ਆਪਣੇ ਖਾਤੇ ਵਿੱਚ ਲੌਗਇਨ ਕਰੋ ਅਤੇ ਓਡਰ ਇਤਿਹਾਸ ਜਾਂ ਮੇਰੇ ਓਡਰ ਭਾਗ ਤੇ ਜਾਓ ਆਪਣਾ ਓਡਰ ਲੱਭੋ ਆਪਣੇ ਓਡਰ ਦੀ ਸੂਚੀ ਵਿੱਚੋਂ ਉਸ ਡਰੈਸ ਦੇ ਓਡਰ ਨੂੰ ਲੱਭੋ ਜਿਸ ਨੂੰ ਤੁਸੀਂ ਰੱਦ ਕਰਨਾ ਚਾਹੁੰਦੇ ਹੋਂ ਉਸ ਤੇ ਬਾਅਦ ਓਡਰ ਰੱਦ ਕਰੋ ਤੇ ਕਲਿੱਕ ਕਰੋ ਓਡਰ ਦੇ ਵੇਵ ਵੇਰਵਿਆਂ ਵਿੱਚ ਤੁਹਾਨੂੰ ਓਡਰ ਰੱਦ ਕਰੋ ਜਾਂ ਕੈਂਸਲ ਓਡਰ ਵਰਗਾ ਇੱਕ ਬਟਨ ਦਿਖਾਈ ਦੇਵੇਗਾ ਇਸ ਤੇ ਕਲਿੱਕ ਕਰੋ ਰੱਦ ਕਰਨ ਦਾ ਕਾਰਨ ਚੁਣੋ ਤੁਹਾਨੂੰ ਓਡਰ ਰੱਦ ਕਰਨ ਦਾ ਕਾਰਨ ਪੁੱਛਿਆ ਜਾਵੇਗਾ ਤੁਸੀਂ ਹੁਣ ਜਰੂਰਤ ਨਹੀਂ ਹੈ ਜਾਂ ਗਲਤ ਓਡਰ ਵਗਰਾ ਕਾਰਨ ਚੁਣ ਸਕਦੇ ਹੋਂ ਜੇ ਜਰੂਰੀ ਹੋਵੇ ਕਈ ਵਾਰ ਤੁਹਨੂੰ ਰੱਦ ਕਰਨ ਦੇ ਕਾਰਨ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਕਿਹਾ ਜਾ ਸਕਦਾ ਹੈ ਤੁਸੀਂ ਸਿਰਫ ਇਹ ਦੱਸ ਸਕਦੇ ਹੋਂ ਕੀ ਤੁਹਾਨੂੰ ਇਸ ਡਰੈਸ ਦੀ ਲੋੜ ਨਹੀਂ ਹੈ ਆਪਣੀ ਬੇਨਤੀ ਜਮਾਂ ਕਰੋ ਇੱਕ ਵਾਰ ਜਦੋਂ ਤੁਸੀਂ ਕਾਰਨ ਚੁਣ ਲੈਂਦੇ ਹੋ ਤਾਂ ਆਪਣੀ ਰੱਦ ਕਰਨ ਦੀ ਬੇਨਤੀ ਜਮਾਂ ਕਰਨ ਲਈ ਓਕੇ ਜਾਂ ਸਬਮਿਟ ਤੇ ਕਲਿੱਕ ਕਰੋ ਇਹ ਕਦਮ ਤੁਹਾਨੂੰ ਤੁਹਾਡਾ ਅਡਰੈਸ ਓਡਰ ਸਫਲਤਾਪੂਰਵਕ ਵਿੱਚ ਬਹੁਤ ਹੀ ਜਿਆਦਾ ਸਹਾਇਕ ਹੋਵੇਗਾ